ਸਾਡੇ ਪਿੰਡ ਵਿੱਚ ਪਰਿਵਾਰਾਂ ਦੇ ਝਗੜਿਆਂ ਦਾ ਹੱਲ ਜ਼ਿਆਦਾਤਰ ਤਾਂ ਘਰਾਂ ਵਿੱਚ ਹੀ ਸੁਲਝਾਏ ਜਾਂਦੇ ਹਨ ਜੇਕਰ ਇਹ ਮਸਲੇ ਘਰਾਂ ਵਿੱਚ ਨਾ ਸੁਲਝੇ ਜਾਣ ਤਾਂ ਇਹ ਝਗੜੇ ਪਿੰਡ ਦੇ ਸਰਪੰਚ ਜਾਂ ਪੰਚ ਹੀ ਇਨ ਝਗੜਿਆਂ ਦਾ ਹੱਲ ਕਰਦੇ ਹਨ ਮੈਂ ਆਪਣੇ ਪਿੰਡ ਦੀ ਗੱਲ ਤੁਹਾਡੇ ਨਾਲ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਵਿੱਚ ਸਾਡੇ ਗੁਆਂਢ ਵਿੱਚ ਹੀ ਕਿਸੇ ਘਰ ਵਿੱਚ ਪਰਿਵਾਰ ਵਿੱਚ ਝਗੜਾ ਹੋ ਗਿਆ ਅਤੇ ਉਹ ਗੱਲ ਇੰਨੀ ਵੱਧ ਗਈ ਕਿ ਉਹ ਪਿੰਡਾਂ ਦੇ ਸਰਪੰਚਾਂ ਤੱਕ ਪੁੱਜ ਗਈ ਬਾਅਦ ਵਿੱਚ ਉਹਨਾਂ ਨੇ ਉਹਨਾਂ ਨੂੰ ਸਮਝਾ ਕੇ ਕਿਹਾ ਕਿ ਤੁਸੀਂ ਆਪਣਾ ਪਰਿਵਾਰਕ ਝਗੜਾ ਆਪਣੇ ਘਰ ਵਿੱਚ ਹੀ ਸੁਲਝਾ ਲਵੋ ਤਾਂ ਉਹਨਾਂ ਨੇ ਬਹੁਤ ਹੀ ਤਰੀਕੇ ਨਾਲ ਉਹਨਾਂ ਦਾ ਆਪਸੀ ਝਗੜਾ ਜੋ ਸੀ ਖਤਮ ਕਰ ਦਿੱਤਾ ਇਸ ਕਰਕੇ ਸਾਡੇ ਪਿੰਡਾਂ ਅਤੇ ਪਰਿਵਾਰਾਂ ਵਿੱਚ ਜੋ ਵੀ ਝਗੜੇ ਹੁੰਦੇ ਹਨ ਉਹ ਜਾਂ ਤਾਂ ਫਿਰ ਘਰ ਵਿੱਚ ਹੀ ਸੁਲਝ ਜਾਂਦੇ ਹਨ ਨਹੀਂ ਤਾਂ ਫਿਰ ਪਿੰਡਾਂ ਦੇ ਸਰਪੰਚ ਜਾਂ ਪੰਚ ਇਹਨਾਂ ਝਗੜਿਆਂ ਦਾ ਨਿਪਟਾਰਾ ਕਰਦੇ ਹਨ